ਮੈਂ ਅੰਸ਼ੁਲ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਮੈਂ ਨਵੀਂ ਚਿੱਤਰਕਾਰੀ ਬਣਾਉਣ ਲਈ ਕਿਹੜੀ ਪ੍ਰਕਿਰਿਆ ਦੁਹਰਾਨਾ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਇੱਕ ਰੈਫਰੈਂਸ ਫੋਟੋ ਜੋ ਜਿਸ ਨੂੰ ਮੈਂ ਆਪਣੇ ਮਤਲਬ ਸ਼ੀਟ ਦੇ ਉੱਤੇ ਬਣਾਉਣਾ ਹੁੰਦਾ ਹੈ ਉਸ ਨੂੰ ਧਿਆਨ ਨਾਲ ਵੇਖਦਾ ਹਾਂ ਉਸਦੀ ਚੰਗੀ ਤਰ੍ਹਾਂ ਜਾਂਚ ਕਰਦਾ ਹਾਂ ਕਿ ਉਹ ਕਿਸ ਸ਼ੇਪ ਵਿੱਚ ਬਣਾਈ ਗਈ ਹੈ ਅਤੇ ਉਸ ਵਿੱਚ ਕਿਸ ਢੰਗ ਦੇ ਮਤਲਬ ਕਿ ਸ਼ੇਡਸ ਵਗੈਰਾ ਜਾਂ ਰੰਗ ਵਗੈਰਾ ਯੂਜ ਕੀਤੇ ਗਏ ਹਨ ਉਸ ਤੋਂ ਬਾਅਦ ਮੈਂ ਗਰੀਡ ਗਰਿਡ ਮੈਥਡ ਦਾ ਯੂਜ ਕਰਦਾ ਹਾਂ ਜਿਵੇਂ ਕਿ ਗਰਿਡ ਮੈਥਡ ਨਾਲ ਥੋੜ੍ਹੀ ਆਸਾਨੀ ਹੁੰਦੀ ਹੈ ਆਊਟਲਾਈਨ ਬਣਾਉਣ ਵਿੱਚ ਸਭ ਤੋਂ ਪਹਿਲਾ ਸਟੈਪ ਸਾਡਾ ਆਊਟਲਾਈਨ ਬਣਾਉਣਾ ਹੁੰਦਾ ਹੈ ਅਤੇ ਚਿੱਤਰਕਾਰੀ ਬਣਾਉਣ ਸਮੇਂ ਮੈਂ ਔਨਲਾਈਨ ਤਰੀਕਿਆਂ ਦੀ ਕਾਫੀ ਮਦਦ ਲੈਂਦਾ ਜਿਵੇਂ ਕਿ ਯੂਟੀਊਬ ਤੋਂ ਜਾਂ ਫਿਰ ਇੰਟਰਨੈਟ ਤੋਂ ਤੇ ਅਤੇ ਗਰਿਡ ਬਣਾਉਣ ਲਈ ਕੁਝ ਐਪਸ ਪਲੇ ਸਟੋਰ 'ਤੇ ਵੀ ਹੈਗੀਆਂ ਨੇ ਜਿਸ ਦੀ ਵਰਤੋਂ ਮੈਂ ਕਰਦਾ ਹਾਂ ਤੇ ਗਰਿਡ ਬਣਾਉਣ ਸਮੇਂ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਗਰਿਡ ਦਾ ਹਰ ਇੱਕ ਡੱਬਾ ਅਤੇ ਉਸ ਦੀ ਹਰ ਇੱਕ ਲਕੀਰ ਬਿਲਕੁਲ ਸਿੱਧੀ ਨੱਬੇ ਡਿਗਰੀ 'ਤੇ ਹੋਵੇ ਕਿ ਜਿਸ ਨਾਲ ਸਾਡੀ ਆਊਟਲਾਈਨ ਬਿਲਕੁਲ ਸਹੀ ਬਣੇ ਅਤੇ ਮੈਂ ਤੁਹਾਨੂੰ ਉਸ ਤੋਂ ਬਾਅਦ ਇਹ ਦੱਸਣ ਜਾ ਰਿਹਾਂ ਕਿ ਜਿਵੇਂ ਉਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੁੰਦਾ ਹੈ ਕਿ ਆਊਟਲਾਈਨ ਨੂੰ ਇੰਝ ਤਿਆਰ ਕਰਨਾ ਕਿ ਉਹ ਸਾਡੀ ਰੈਫਰੈਂਸ ਫੋਟੋ ਨਾਲ ਮੇਲ ਖਾਂਦੀ ਹੋਵੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਸਾਡੀ ਅੱਖਾਂ ਬਣਾਉਣ ਦੀ ਜਿਵੇਂ ਕਿ ਮੰਨ ਕੇ ਚੱਲੀਏ ਕਿ ਮੈਂ ਇੱਕ ਕਿਸੇ ਦੀ ਸ਼ਕਲ ਬਣਾ ਰਿਹਾਂ ਅਤੇ ਉਸ ਵਿੱਚ ਸਾਡੀ ਵਾਰੀ ਆਏਗੀ ਕਿਸੇ ਦੀਆਂ ਅੱਖਾਂ ਬਣਾਉਣ ਦੀ ਅਤੇ ਉਸ ਤੋਂ ਬਾਅਦ ਜਿਵੇਂ ਕਿ ਅੱਖਾਂ ਤੋਂ ਬਾਅਦ ਜਿਵੇਂ ਕਿ ਨੱਕ ਬਣਾ ਸਕਦੇ ਈਂ ਉਸ ਤੋਂ ਬਾਅਦ ਅਸੀਂ ਬੁੱਲ ਬਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੋ ਵਾਰੀ ਆਉਂਦੀ ਹੈ ਕਿ ਇੱਕ ਵਾਰ ਅਸੀਂ ਫਿਰ ਚੈੱਕ ਕਰਦੇ ਹਾਂ ਕਿ ਜੋ ਗਲਤੀ ਹੈ ਉਸਨੂੰ ਇਰੇਜ਼ ਕਰਕੇ ਉਸਨੂੰ ਠੀਕ ਕਰਦੇ ਹਾਂ ਅਤੇ ਫਿਰ ਸਾਡੀ ਆਊਟਲਾਈਨ ਵਗੈਰਾ ਤਿਆਰ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀਂ ਉਸ ਵਿੱਚ ਹੁਣ ਸ਼ੇਡਿੰਗ ਕਰਨ ਦੀ ਕੋਸ਼ਿਸ਼ ਕਰਨੀ ਹੈ ਸ਼ੇਡਿੰਗ ਅਸੀਂ ਪੈਨਸਲ ਨਾਲ ਕਰ ਸਕਦੇ ਹਾਂ ਅਤੇ ਜੇ ਅਸੀਂ ਰੰਗ ਵਾਲੀ ਬਣਾਉਣੀ ਹੈ ਅਤੇ ਉਸ ਵਿੱਚ ਰੰਗ ਭਰ ਸਕਦੇ ਹਾਂ ਅਤੇ ਹਾਲ ਹੀ ਵਿੱਚ ਬਣਾਈ ਗਈ ਚਿੱਤਰਕਾਰੀ ਦੇ ਪਿੱਛੇ ਮੇਰੀ ਇਹੀ ਪ੍ਰਕਿਰਿਆ ਸੀ ਕਿਉਂਕਿ ਹਾਲ ਵਿੱਚ ਮੈਂ ਇੱਕ ਪ੍ਰੇ ਜੋ ਚਿੱਤਰ ਬਣਾਇਆ ਸੀ ਉਹ ਇੱਕ ਔਡਰ ਮਿਲਿਆ ਸੀ ਮੈਨੂੰ ਜਿਸ ਵਿੱਚ ਮਤਲਬ ਮੈਂ ਦੋ ਮ ਮਤਲਬ ਕਿ ਇੱਕ ਕਪਲਸ ਦੀ ਫੋ ਸਕੈਚ ਬਣਵਾਉਣਾ ਸੀ ਅਤੇ ਉਹਦੇ ਵਿੱਚ ਮੈਂ ਸੇਮ ਪ੍ਰਕਿਰਿਆ ਯੂਜ ਕੀਤੀ ਸੀ ਪਹਿਲੇ ਗ੍ਰੀ ਗ੍ਰਿਡ ਮੈਥਡ ਵਰਤਿਆ ਉਸ ਤੋਂ ਬਾਅਦ ਆਊਟਲਾਈਨ ਅਤੇ ਫਿਰ ਉਹਨਾਂ ਦੇ ਜੋ ਉਹਨਾਂ ਦੇ ਬੋਡੀ ਪਾਰਟਸ ਜੋ ਵੀ ਮਤਲਬ ਸੀ ਅਤੇ ਉਸ ਤੋਂ ਬਾਅਦ ਮੈਂ ਆਊਟਲਾਈਨ ਤੋਂ ਬਾਅਦ ਸਾਰਾ ਮਤਲਬ ਜਦੋਂ ਇਹ ਆਊਟਲਾਈਨ ਹੋ ਗਈ ਉਸ ਤੋਂ ਬਾਅਦ ਸਾਰੀ ਸ਼ੇਡਿੰਗ ਦੀ ਵਾਰੀ ਸੀ ਅਤੇ ਸ਼ੇਡਿੰਗ ਤੋਂ ਬਾਅਦ ਇੱਕ ਸਾਡਾ ਹੋਰ ਸਟੈਪ ਹੁੰਦਾ ਜਿੱਦਾਂ ਮਤਲਬ ਉਸਨੂੰ ਕੋਟਨ ਵਗੈਰਾ ਜਾਂ ਫਿਰ ਕੋਈ ਪੇਪਰ ਟਿਸ਼ੂ ਪੇਪਰ ਵਗੈਰਾ ਨਾਲ ਉਸਨੂੰ ਚੰਗੀ ਤਰ੍ਹਾਂ ਰਬ ਕਰਨਾ ਉਸਨੂੰ ਸਪੰਜ ਕਹਿੰਦੇ ਨੇ ਅਤੇ ਜਿਸ ਨਾਲ ਮਤਲਬ ਜੋ ਸਾਡੀ ਕਲਰਿੰਗ ਕਲਰਿੰਗ ਹੈ ਉਹ ਬਿਲਕੁਲ ਨਿਖਰ ਕੇ ਆਉਂਦੀ ਹੈ ਅਤੇ ਬਹੁਤ ਹੀ ਮਤਲਬ ਸਾਡਾ ਜੋ ਸਕੈਚ ਵਗੈਰਾ ਜਾਂ ਜੋ ਸਾਡੀ ਚਿੱਤਰਕਾਰੀ ਹੈ ਉਹ ਬਹੁਤ ਹੀ ਵਧੀਆ ਵਧੀਆ ਲੱਗਦੀ ਹੈ ਅਤੇ ਇੱਦਾਂ ਲੱਗਦੀ ਹੈ ਕਿ ਜਿਵੇਂ ਅਸਲ ਹੋਵੇ